ਮੇਰਾ ਪਸੰਦੀਦਾ ਖੇਡ ਖਿਡਾਰੀ ਵਿਰਾਟ ਕੋਹਲੀ ਹੈ ਜਿਸ ਦਾ ਜਨਮ ਪੰਜ ਨਵੰਬਰ ਉਨੀ ਸੌ ਅਠਾਸੀ ਭਾਰਤ ਵਿੱਚ ਹੋਇਆ ਹੈ ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਅਤੇ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਹੈ ਉਹ ਵਰਤਮਾਨ ਵਿੱਚ ਆਈ ਪੀ ਐਲ ਰਿਹਾ ਹੈ ਉਹ ਨਵੀਂ ਦਿੱਲੀ ਵਿੱਚ ਜੰਮੇ ਅਤੇ ਵੱਡੇ ਹੋਏ ਕੋਹਲੀ ਦੇ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲਈ ਅਤੇ ਦਿੱਲੀ ਐਂਡ ਪੰਦਰਾਂ ਟੀਮਾਂ ਨਾਲ ਆਪਣੇ ਨੌਜਵਾਨ ਕਰੀਅਰ ਦੀ ਸ਼ੁਰੂਆਤ ਕੀਤੀ ਉਸ ਨੇ ਦੋ ਹਜ਼ਾਰ ਅੱਠ ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ ਇੱਕ ਦਿਨਾਂ ਟੀਮ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣ ਗਿਆ ਉਸ ਨੇ ਦੋ ਹਜ਼ਾਰ ਦਸ ਵਿੱਚ ਆਪਣਾ ਟੀ ਵੀਹ ਨਾਲ ਡੈਬੀਓ ਕੀਤਾ ਅਤੇ ਬਾਅਦ ਵਿੱਚ ਦੋ ਹਜ਼ਾਰ ਗਿਆਰਾਂ ਵਿੱਚ ਆਪਣਾ ਟੈਬ ਟੈਸਟ ਡੇਬੀਓ ਕੀਤਾ ਦੋ ਹਜ਼ਾਰ ਤੇਰਾਂ ਵਿੱਚ ਕਰੋ ਕੋਹਲੀ ਪਹਿਲੀ ਵਾਰ ਵੰਨ ਡੇ ਵਾਲੀ ਵਾਜਾ ਲਈ ਆਈ ਸਿਸ ਰੈਕਿੰਗ ਵਿਚ ਪਹਿਲੇ ਨੰਬਰ 'ਤੇ ਪਹੁੰਚਿਆ ਜੇਕਰ ਮੈਂ ਉਸ ਨੂੰ ਮਿਲਦੀ ਹਾਂ ਤਾਂ ਮੈਂ ਉਸ ਨੂੰ ਇਹ ਹੀ ਪੁੱਛਾਂਗੀ ਕਿ ਤੁਸੀਂ ਬਚਪਨ ਤੋਂ ਲੈ ਕੇ ਤੁਹਾਡੀ ਹੁਣ ਤੱਕ ਦੀ ਕੀ ਸਿਖਲਾਈ ਹੈ ਅਤੇ ਤੁਸੀਂ ਨੇ ਆਪਣੇ ਜੀਵਨ ਵਿੱਚ ਕਿਵੇਂ ਸੰਘਰਸ਼ ਕੀਤਾ